ਨੌਜਵਾਨਾਂ ਵਿੱਚ ਬੇਰੁਜ਼ਗਾਰੀ ਬੇਰੁਜ਼ਗਾਰੀ ਦਾ ਕਾਰਨ ਉਹ ਆਪ ਹਨ ਅਤੇ ਸਰਕਾਰ ਹੈ ਰੁਜ਼ਗਾਰ ਦੋ ਤਰ੍ਹਾਂ ਦੇ ਹੁੰਦੇ ਬੁੰਦੇ ਹਨ ਇੱਕ ਸਰਕਾਰੀ ਰੁਜ਼ਗਾਰ ਇੱਕ ਪ੍ਰਾਈਵੇਟ ਰੁਜ਼ਗਾਰ ਸਰਕਾਰੀ ਰੁਜ਼ਗਾਰ ਇੱਕ ਐਸੀ ਚੀਜ਼ ਹੋ ਗਈ ਹੈ ਜੋ ਕਿ ਹਰ ਬੰਦੇ ਦਾ ਕੰਮ ਨਹੀਂ ਰਿਹਾ ਕਿਉਂਕਿ ਇੰਨਾ ਕੋਂਪਟੀਸ਼ਨ ਹੋ ਚੁੱਕਾ ਹੈ ਕਿ ਨੌਕਰੀਆਂ ਬਹੁਤ ਘੱਟ ਨੇ ਅਤੇ ਪੇਪਰ ਦੇਣ ਵਾਲੇ ਬੱਚੇ ਬਹੁਤ ਜ਼ਿਆਦਾ ਹਨ ਅਤੇ ਜੇਕਰ ਅਸੀਂ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ ਤਾਂ ਵੀ ਬਹੁਤ ਘੱਟ ਚਾਂਸ ਹੈ ਕਿ ਸਾਨੂੰ ਨੌਕਰੀ ਮਿਲ ਸਕੇ ਕਿਉਂਕਿ ਜੇਕਰ ਅਸੀਂ ਨੌਕਰੀ ਲੱਗ ਵੀ ਜਾਈਏ ਤਾਂ ਵੀ ਸਾਡਾ ਪੂਰਾ ਪੱਕਾ ਨਹੀਂ ਹੁੰਦਾ ਕਿ ਸਾਡੀ ਨੌਕਰੀ ਹੈ ਵੀ ਹੈ ਕਿ ਨਹੀਂ ਅਸੀਂ ਜੇ ਗੱਲ ਕਰੀਏ ਬੱਚਿਆਂ ਦੀ ਤਾਂ ਬੱਚਿਆਂ ਵਿੱਚ ਵੀ ਉਹ ਜਜ਼ਬਾਤ ਅਤੇ ਜਨੂਨ ਨਹੀਂ ਹੈ ਕਿ ਉਹ ਵੀ ਕੁਛ ਪੜ੍ਹ ਲਿਖ ਕੇ ਬਣਨ ਤੁਹਾਨੂੰ ਹਮੇਸ਼ਾ ਇਹ ਸੋਚਣਾ ਚਾਹੀਦਾ ਹੈ ਕਿ ਸਰਕਾਰ ਵੀ ਸਾਡੇ ਵਾਸਤੇ ਸਹੂਲਤਾਂ ਕੱਢ ਰਹੀ ਹੈ ਪਰ ਬੱਚਿਆਂ ਦਾ ਵੀ ਖੋਟ ਹੁੰਦਾ ਹੈ ਸਰਕਾਰ ਨੂੰ ਵੱਧ ਤੋਂ ਵੱਧ ਫੈਕਟਰੀਆਂ ਅਤੇ ਇੰਡਸਟਰੀ ਖੋਲ੍ਹਣੀ ਚਾਹੀਦੀ ਹਨ ਤਾਂ ਲੋਕ ਪੰਜਾਬ ਵਿੱਚ ਹੋਰ ਰੁਜ਼ਗਾਰ ਵਧੇ ਅਤੇ ਬੱਚਿਆਂ ਦਾ ਭਵਿੱਖ ਸਹੀ ਹੋ ਸਕੇ